ਹੈਲੋ ਸੱਤ ਸ਼੍ਰੀ ਅਕਾਲ ਹਾਂਜੀ ਕੋਲ ਵਾਲ਼ਾ ਰਾਜੂ ਬੋਲਦੇ ਜੀ ਹਾਂਜੀ ਹਾਂਜੀ ਮੈਂ ਉਹਨਾਂ ਤੋ ਕੈਬ ਕੀਤੀ ਸੀਗੀ ਜੀ ਇੱਕ ਨਵਾਂਸ਼ਹਿਰ ਤੋਂ ਬਿਆਸ ਜਾਣਾ ਜੀ ਮੈਂ ਹਾਂਜੀ ਕੱਲ੍ਹ ਕੀਤੀ ਸੀਗੀ ਜੀ ਹਾਂਜੀ ਬਿਆਸ ਜੀ ਹਾਂਜੀ ਬਿਆਸ ਜੀ ਮੈਂ ਅੱਠ ਵਜੇ ਪਹੁੰਚਣਾ ਸੀ ਅੱਜ ਅਤੇ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਮੇਰੇ ਇਥੇ ਬਿਆਸ ਮੈਂ ਬਸ ਸਟੇਸ਼ਨ 'ਤੇ ਜਾਣਾ ਹਾਂਜੀ ਹਾਂਂ ਹਾਂਜੀ ਤੁਸੀਂ ਕਿੰਨੇ ਵਜੇ ਪਹੁੰਚੋਗੇ ਜੀ ਕਿਉਂਕਿ ਤਿੰਨ ਘੰਟੇ ਲੱਗ ਵੀ ਜਾਂਦੇ ਜੀ ਨਵਾਂਸ਼ਹਿਰ ਤੋਂ ਬਿਆਸ ਨੂੰ ਤੁਹਾਨੂੰ ਵੀ ਪਤਾ ਏ ਜੀ ਸਾਢੇ ਚਾਰ ਹੋ ਗਏ ਇਸ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਕਿੰਨੇ ਕੁ ਵਜੇ ਤੱਕ ਆਜੋਂਗੇ ਜੀ ਤੁਸੀਂ ਹਾਂਜੀ ਠੀਕ ਹੈ ਜੀ ਆ ਜਿਓ ਛੇ ਕੁ ਵਜੇ ਤੱਕ ਆ ਜਿਓ ਜੀ ਛੇ ਵਜੇ ਤਾਂ ਜੀ ਜ਼ਿਆਦਾ ਟਾਈਮ ਹੋ ਜਾਣਾ ਸਾਨੂੰ ਆਪਾਂ ਅੱਠ ਵਜੇ ਪਹੁੰਚਣਾ ਏ ਤੁਸੀਂ ਪੰਜ ਸਵਾ ਪੰਜ ਦੇ ਵਿੱਚ ਆ ਜਿਓ ਭਾਈ ਸਾਹਿਬ ਤਾਂ ਜ਼ਿਆਦਾ ਵਧੀਆ ਹੋਵੇਗਾ ਜੀ ਠੀਕ ਹੈ ਭਾਈ ਸਾਹਿਬ ਤੁਸੀਂ ਆ ਜਿਓ ਛੇਤੀ ਕਿਉਂਕਿ ਜੀ ਮੈਂ ਉਥੇ ਸਤਿਸੰਗ ਸੁਣਨ ਜਾਣਾ ਜੀ ਅੱਠ ਵਜੇ ਮੈਂ ਉੱਥੇ ਹੋਣੀ ਚਾਹੀਦੀ ਬੱਸ ਸਟੇਸ਼ਨ 'ਤੇ ਤਾਂ ਹੀ ਮੈਂ ਉਥੇ ਡੇਰੇ 'ਚ ਪਹੁੰਚੂਗੀ ਜੀ ਠੀਕ ਹੈ ਭਾਈ ਸਾਹਿਬ ਠੀਕ ਹੈ ਜੀ ਪਹੁੰਚ ਜਿਓ ਜੀ ਟਾਈਮ ਨਾਲ਼ ਮੈਂ ਤੁਹਾਡੀ ਪੰਜ ਪੌਣੇ ਪੰਜ ਪੰਜ ਵਜੇ ਇੰਤਜ਼ਾਰ ਕਰਦੀ ਹਾਂ ਜੀ ਘਰ ਤੋਂ ਬਾਹਰ ਠੀਕ ਹੈ ਭਾਈ ਸਾਹਿਬ